ਪੰਜਾਬ ਭੁਗੋਲਿਕ ਤੌਰ 'ਤੇ ਬਹੁਤ ਹੀ ਅਮੀਰ ਧਰਤੀ ਹੈ ਇਸਦਾ ਨਾਂ ਪੰਜਾਬ ਪੰਜ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਜੋ ਕਿ ਹਨ ਪੰਜ ਪਲੱਸ ਆਬ ਜਿਸ ਦਾ ਮਤਲਬ ਹੈ ਪੰਜ ਦਰਿਆਵਾਂ ਦੀ ਧਰਤੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਮੁੱਖ ਤੌਰ 'ਤੇ ਤਿੰਨ ਇਲਾਕੇ ਹਨ ਜਿਨਾਂ ਦਾ ਨਾਂ ਹੈ ਜਿਸ ਵਿੱਚੋਂ ਪਹਿਲਾ ਇਲਾਕਾ ਹੈ ਮਾਲਵਾ ਦੂਜਾ ਹੈ ਮਾਝਾ ਅਤੇ ਤੀਜਾ ਹੈ ਦੁਆਬਾ ਮਾਲਵਾ ਇਲਾਕਾ ਸਭ ਤੋਂ ਵੱਡਾ ਇਲਾਕਾ ਹੈ ਇਸ ਵਿੱਚ ਕੁੱਲ ਪੰਦਰ੍ਹਾਂ ਡਿਸਟਰਿਕਟ ਆਉਂਦੇ ਹਨ ਇਹ ਸਤਲੁਜ ਤੋਂ ਥੱਲੇ ਦੀ ਧਰਤੀ ਹੈ ਅਤੇ ਇਸ ਤੋਂ ਇਲਾਵਾ ਦੂਜਾ ਇਲਾਕਾ ਮਾਝਾ ਹੈ ਜਿਸ ਵਿੱਚ ਬਿਆਸ ਜਿਹੜਾ ਕਿ ਬਿਆਸ ਅਤੇ ਰਾਵੀ ਦਰਿਆ ਦੇ ਵਿਚਕਾਰ ਦੀ ਥਾਂ ਹੈ ਇਸ ਵਿੱਚ ਚਾਰ ਡਿਸਟਰਿਕਟ ਆਉਂਦੇ ਹਨ ਅੰਬਰਸਰ ਜਾਂ ਅੰਮ੍ਰਿਤਸਰ ਗੁਰਦਾਸਪੁਰ ਤਰਨ ਤਾਰਨ ਅਤੇ ਪਠਾਨਕੋਟ ਇਹ ਇਸ ਨੂੰ ਵਿਚਾਲੜਾ ਵੀ ਇਲਾਕਾ ਕਿਹਾ ਜਾਂਦਾ ਹੈ ਕਿਉਂਕਿ ਇਹ ਪੰਜਾਬ ਦੀ ਵੰਡ ਹੋਣ ਤੋਂ ਪਹਿਲਾਂ ਸਭ ਤੋਂ ਵਿਚਾਲੇ ਆਉਂਦਾ ਸੀ ਇਹ ਸਭ ਤੋਂ ਉਪਜਾਊ ਧਰਤੀ ਹੈ ਇਸ ਤੋਂ ਇਲਾਵਾ ਤੀਜਾ ਇਲਾਕਾ ਦੁਆਬਾ ਹੈ ਜਿਸ ਵਿੱਚ ਵੀ ਚਾਰ ਡਿਸਟਰਿਕਟਸ ਆਉਂਦੇ ਹਨ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਇਸ ਵਿੱਚ ਰਹਿਣ ਲਈ ਜਗ੍ਹਾ ਘੱਟ ਹੈ ਇਸ ਕਰਕੇ ਇੱਥੇ ਖੇਤੀ ਵੀ ਘੱਟ ਹੁੰਦੀ ਖੇਤੀ ਲਈ ਜਗ੍ਹਾ ਵੀ ਬਹੁਤ ਘੱਟ ਹੈ ਇੱਥੋਂ ਦੇ ਲੋਕ ਜ਼ਿਆਦਾਤਰ ਬਾਹਰ ਜਾਂਦੇ ਹਨ ਜਾਂ ਫਿਰ ਇੱਥੇ ਰਹਿ ਕੇ ਹੀ ਮਿਹਨਤ ਕਰਕੇ ਸਰਕਾਰੀ ਨੌਕਰੀ ਯਾਂ ਫਿਰ ਪ੍ਰਾਇਵੇਟ ਨੌਕਰੀ ਕਰਦੇ ਹਨ ਜਿਹੜਾ ਮਾਲਵਾ ਇਲਾਕਾ ਹੈ ਉਸ ਵਿੱਚ ਜਿਹੜੀ ਭਾਸ਼ਾ ਬੋਲੀ ਜਾਂਦੀ ਹੈ ਉਸਨੂੰ ਮਲਵਈ ਕਹਿੰਦੇ ਹਨ ਅਤੇ ਇਸ ਵਿਚ ਇਸ ਇੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਮਲ ਮਲਵਈ ਕਹਿੰਦੇ ਹਨ ਅਤੇ ਇੱਥੋਂ ਦੀ ਬੋਲੀ ਜਾਣ ਵਾਲੀ ਭਾਸ਼ਾ ਮ ਮਲਵਈ ਹੈ ਇਸ ਤੋਂ ਇਲਾਵਾ ਮਾਝੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਮਾਝੀ ਕਹਿੰਦੇ ਹਨ ਅਤੇ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਮਝੈਲ ਕਹਿੰਦੇ ਹਨ ਅਤੇ ਇਸ ਤੋਂ ਇਲਾਵਾ ਦੁਆਬੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਦੁਆਬੀ ਕਹਿੰਦੇ ਹਨ ਅਤੇ ਇੱਥੋਂ ਦੀ ਭਾਸ਼ਾ ਵੀ ਦੁਆਬੀ ਬੋਲੀ ਜਾਂਦੀ ਹੈ ਇਸ ਤੋਂ ਇਲਾਵਾ ਇੱਕ ਜ਼ਰੂਰੀ ਸਥਾਨ ਹੈ ਜਿਸ ਦਾ ਨਾਂ ਹਰੀ ਕੇ ਪੱਤਨ ਹੈ ਇਹ ਫਿਰੋਜ਼ਪੁਰ ਕਪੂਰਥਲਾ ਤਰਨ ਤਾਰਨ ਦੇ ਵਿਚਾਲੇ ਆਉਂਦਾ ਹੈ